ਮੈਂ ਸ਼ਹਿਰ ਵਿੱਚ ਰਹਿਣ ਵਾਲੀ ਨਹੀਂ ਹਨ ਮੈਂ ਪਿੰਡਾਂ ਵਿੱਚ ਰਹਿਣ ਵਾਲੀ ਹਾਂ ਅਤੇ ਸਾਡੇ ਪਿੰਡ ਵਿੱਚ ਹੋਮਸਟੇਅ ਦੇ ਕੁਝ ਜ਼ਿਆਦਾ ਸਹੂਲਤਾਂ ਨਹੀਂ ਹਨ ਅਤੇ ਨਾ ਹੀ ਇੱਥੇ ਕੋਈ ਜ਼ਿਆਦਾ ਪ੍ਰਬੰਧ ਹੈ ਨਾ ਇੱਥੇ ਨਾ ਹੀ ਕੋਈ ਜ਼ਿਆਦਾ ਰੁਕਦਾ ਹੈ ਅਤੇ ਸਾਰੇ ਹੀ ਸ਼ਹਿਰ ਵੱਲ ਭੱਜਦੇ ਹਨ ਅਤੇ ਸ਼ਹਿਰ ਵਿੱਚ ਬਹੁਤ ਸਾਰੇ ਹੋਮਸਟੇਅ ਹਨ ਅਤੇ ਉਹਨਾਂ ਦੀ ਸਹੂਲਤਾਂ ਵਿੱਚ ਉਹ ਰਹਿਣਾ ਚਾਹੁੰਦੇ ਹਨ ਅਤੇ ਮੈਂ ਇਹਨਾਂ ਬਾਰੇ ਕੁਛ ਨਹੀਂ ਕਹਿਣਾ ਚਾਹੁੰਦੀ